ਪਹਿਲਾਂ ਤਾਂ ਬਾਈਕਿੰਗ ਗੇਅਰ ਵੀ ਜਿਵੇਂ ਆਪਾਂ ਕਿਤੇ ਬਾਈਕ 'ਤੇ ਜਾ ਰਹੇ ਹਾਂ ਆਪਾਂ ਨੇ ਲੰਬਾ ਰੂਟ ਲੰਬੇ ਰੂਟ ਜਾਣਾ ਹੈ ਤਾਂ ਆਪਾਂ ਨੂੰ ਨਾਲ ਪਹਿਲਾਂ ਤਾਂ ਉਹਦੇ ਸਮਾਨ ਰੱਖਣੇ ਪੈਣਗੇ ਜਿਵੇਂ ਕਿ ਪਲਾਸ ਪੇਚਕਸ ਇੱਕ ਦੋ ਚਾਬੀ ਜਿਹੜੀ ਮੇਨ ਹੈ ਉਹ ਨਾਲ ਰੱਖਣੀ ਪਵੇਗੀ ਅਤੇ ਗੇਅਰ ਵਾਇਰ ਕਲੱਚ ਵਾਇਰ ਅਤੇ ਰੇਸਿੰਗ ਵਾਇਰ ਇਹ ਵਾਇਰਾਂ ਨਾਲ ਰੱਖਣੀ ਪੈਣਗੀਆਂ ਅਤੇ ਟਿਊਬ ਜਿਵੇਂ ਹਿੱਲ ਸਟੇਸ਼ਨਾਂ 'ਤੇ ਜਾਣਾ ਟਿਊਬ ਇਕ ਐਕਸਟਰਾ ਰੱਖ ਲਓ ਤਾਂ ਕਿ ਰਸਤੇ 'ਚ ਲੋੜ ਪੈ ਸਕਦੀ ਹੈ ਕੋਈ ਵੀ ਦਿੱਕਤ ਆ ਸਕਦੀ ਹੈ ਆਪਾਂ ਨੂੰ ਉਹ ਟਿਊਬ ਚੇਂਜ ਕਰਾ ਕੇ ਆਪਾਂ ਨੂੰ ਨਹੀਂ ਮਿਲੇ ਤਾਂ ਆਪਾਂ ਆਪ ਵੀ ਚੇਂਜ ਕਰ ਸਕਦੇ ਹਾਂ ਪੇਚਕਸ ਵਗੈਰਾ ਰੱਖੇ ਨਾਲ ਅਤੇ ਸਾਈਕਲ 'ਤੇ ਆਪਾਂ ਜਾ ਰਹੇ ਹਾਂ ਸਾਈਕਲ 'ਤੇ ਆਪਾਂ ਨੂੰ ਇੱਕ ਦੋ ਸਮਾਨ ਨਾਲ ਰੱਖਣਾ ਪੈਂਦਾ ਹੈ ਜਿਵੇਂ ਕਿ ਸਾਈਕਲ ਮੇਰਾ ਇੱਕ ਵਾਰ ਖ਼ਰਾਬ ਹੋ ਗਿਆ ਅਤੇ ਮੈਂ ਪੈਦਲ ਦਸ ਕਿਲੋਮੀਟਰ ਪੈਦਲ ਚੱਲਣਾ ਪਿਆ ਅਤੇ ਮੈਨੂੰ ਪੈਂਚਰ ਵਾਲਾ ਵੀ ਨਹੀਂ ਮਿਲਿਆ ਅਤੇ ਇਸ ਤਰ੍ਹਾਂ ਮੈਂ ਪੈਂਚਰ ਵਾਲਾ ਢੂੰਡਿਆ ਫਿਰ ਪੈਂਚਰ ਲਗਵਾਇਆ ਫਿਰ ਮੈਂ ਗਿਆ ਸਾਈਕਲ 'ਤੇ ਚੜਿਆ ਇਸ ਤਰ੍ਹਾਂ ਮੈਨੂੰ ਦਸ ਕਿਲੋਮੀਟਰ ਪੈਦਲ ਚੱਲਣਾ ਪਿਆ ਅਤੇ ਸਾਈਕਲ ਨਾਲ ਵੀ ਇੱਕ ਦੋ ਮੇਨ ਚਾਬੀ ਜਿਹੜੀ ਉਹ ਰੱਖ ਲਵੋ ਤਾਂ ਕਿ ਬ੍ਰੇਕ ਬਰੂਕ ਢਿੱਲੀ ਟਾਇਟ ਟੂਟ ਕਰ ਸਕੇ ਪੇਚਕਸ ਵਗੈਰਾ ਅਤੇ ਇਸ ਤਰ੍ਹਾਂ ਬਾਈਕ ਦਾ ਬਾਈਕ ਦੇ ਵੀ ਜਦੋਂ ਆਪਾਂ ਜਾਂਦੇ ਹਾਂ ਕਿਤੇ ਲੰਬੇ ਰੂਟ ਜਾਂਦੇ ਹਾਂ ਤਾਂ ਓ ਜੋ ਜੋ ਮੈਂ ਦੱਸਿਆ ਵਾਇਰ ਕਲੱਚ ਵਾਇਰ ਗੇਅਰ ਵਾਇਰ ਜਾਂ ਫਿਰ ਅਤੇ ਪ ਪਲਾਸ ਪੇਚਕਸ ਚਾਬੀ ਆਦਿ ਇਹ ਚੀਜ਼ਾਂ ਨਾਲ ਰੱਖ ਲਵੋ ਅਤੇ ਅਸਫਲਤਾ ਦਾ ਸਾਹਮਣਾ ਤਾਂ ਮੈਂ ਇਸ ਤਰ੍ਹਾਂ ਕੀਤਾ ਕਿ ਸਾਈਕਲ ਆ ਜਿਹੜਾ

ਵਧੀਆ ਸਵਾਰੀ ਹੈ ਲੇਕਿਨ ਜੇ ਕਿਤੇ ਦਿੱਕਤ ਆਉਂਦੀ ਹੈ ਤਾਂ ਇਸ ਨੂੰ ਥੋੜ੍ਹਾ ਜਿਹਾ ਆਪ ਠੀਕ ਕਰਨਾ ਜ਼ਰੂਰੀ ਹੋ ਜਾਂਦਾ ਜ਼ਰੂਰੀ ਹੈ ਨਹੀਂ ਕਿ ਆਪਾਂ ਨੂੰ ਮਕੈਨਿਕ ਮਿਲੇਗਾ ਹੀ ਮਿਲੇਗਾ ਐਸਾ ਸਥਾਨ ਵੀ ਹੁੰਦਾ ਜਿੱਥੇ ਆਪਾਂ ਨੂੰ ਮਕੈਨਿਕ ਨਹੀਂ ਮਿਲਦਾ ਕਿ ਆਪਾਂ ਨੂੰ ਥੋੜ੍ਹਾ ਜਿਹਾ ਆਪ ਕਰਨਾ ਪੈਂਦਾ ਜਿਵੇਂ ਕਿ ਪੈਂਚਰ ਹੋ ਗਿਆ ਪੰਪ ਜ਼ਰੂਰੀ ਹੈ ਪੰਪ ਹਵਾ ਭਰ ਕੇ ਕੁਛ ਟਾਈਮ ਤੱਕ ਆਪਾਂ ਨੂੰ ਉੱਥੇ ਪਹੁੰਚਾ ਸਕਦਾ ਜਿੱਥੇ ਆਪਾਂ ਨੇ ਜਾਣਾ ਹੈ ਅਤੇ ਬਾਲ ਕਈ ਵਾਰ ਬਾਲ ਫੱਟ ਜਾਂਦਾ ਬਾਲ ਵੀ ਰੱਖਣਾ ਚਾਹੀਦਾ ਨਾਲ ਅਤੇ ਇਸ ਤਰ੍ਹਾਂ ਆਪਾਂ ਨੂੰ ਕੁਛ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਤਾਂ ਆਪਾਂ ਆਪਣਾ ਸਫ਼ਰ ਸਹੀ ਤਰੀਕੇ ਨਾਲ ਕਰ ਸਕੀਏ